ਮੈਨੂੰ ਆਪਣੇ ਸ਼ਹਿਰ ਦੀ ਜੋ ਸਭ ਤੋਂ ਵਧੀਆ ਚੀਜ਼ ਲੱਗਦੀ ਹੈ ਉਹ ਇੱਥੋਂ ਦੇ ਮੰਦਰ ਅਤੇ ਗੁਰਦੁਆਰੇ ਹਨ ਜਿੱਥੇ ਮੈਨੂੰ ਜਾਣਾ ਬਹੁਤ ਪਸੰਦ ਹੈ ਜਦੋਂ ਵੀ ਮੈਨੂੰ ਸ਼ਾਂਤੀ ਦੀ ਜ਼ਰੂਰਤ ਹੁੰਦੀ ਹੈ ਤਾਂ ਮੈਂ ਉੱਥੇ ਜਾ ਕੇ ਆਪਣਾ ਧਿਆਨ ਲਗਾਉਂਦੀ ਹਾਂ ਪਾਠ ਕਰਦੀ ਹਾਂ ਅਤੇ ਮੈਨੂੰ ਮਾਨਸਿਕ ਸੰਤੁਲਨ ਮਿਲਦਾ ਹੈ ਇਸ ਤੋਂ ਇਲਾਵਾ ਇਹ ਮੈਨੂੰ ਸ਼ਾਂਤ ਰਹਿਣ ਵਿੱਚ ਸਹਿਜਤਾ ਨਾਲ਼ ਕੰਮ ਕਰਨ ਦੇ ਵਿੱਚ ਅਤੇ ਧਿਆਨ ਨਾਲ਼ ਸੋਚਣ ਦੇ ਲਈ ਪ੍ਰੇਰਿਤ ਕਰਦੀ ਹੈ